ਸਕੂਲ ਟਾਈਮ ਦੇ ਵਿੱਚ ਪਲੱਸ ਟੂ ਦੇ ਵਿੱਚ ਮੇਰਾ ਲੌਂਗ ਜੰਪ ਦੇ ਵਿੱਚ ਫਸਟ ਪ੍ਰਾਈਜ਼ ਆਇਆ ਸੀਗਾ ਉਸ ਟਾਈਮ ਬੜਾ ਮਾਣ ਵਾਲ਼ੀ ਗੱਲ ਸੀਗੀ ਵੀ ਜੋ ਕਿ ਖੇਡ ਪ੍ਰਤੀ ਜਿਹੜਾ ਪਿਆਰ ਸੀਗਾ ਉਹਨੂੰ ਮੁੱਖ ਰੱਖਦੇ ਹੋਏ ਉਸ ਟਾਈਮ ਸਾਰੇ ਜਿਹੜੇ ਸਾਡੇ ਟੀਚਰ ਸੀਗੇ ਉਹਨਾਂ ਨੇ ਸਾਨੂੰ ਗੋਦੀ ਚੱਕ ਲਿਆ ਪੂਰੀ ਜੈ ਜੈ ਕਾ ਕਾਰ ਹੋਈ ਉਹ ਬੜਾ ਮਾਣ ਮਹਿਸੂਸ ਹੋਇਆ ਉਸ ਚੀਜ਼ 'ਤੇ ਉਸ ਤੋਂ ਬਾਅਦ ਜਿਊਂ ਜਿਊਂ ਉਮਰ ਵੱਧਦੀ ਗਈ ਪਾਠ ਕਰਨ ਦੇ ਵਿੱਚ ਗੁਰਸਿੱਖੀ ਨਾਲ਼ ਪ੍ਰੇਮ ਪਿਆਰ ਉਹ ਵੀ ਵੱਧਦਾ ਗਿਆ ਇੱਕ ਸਭ ਤੋਂ ਮਾਣ ਮਹਿਸੂਸ ਕਰੀਦਾ ਵੀ ਜਿਹੜਾ ਗੁਰੂ ਘਰ ਨਾਲ਼ ਪਿਆਰ ਹੈ ਔਰ ਪਾਠ ਕਰਨਾ ਜਦੋਂ ਸਪੀਕਰ 'ਤੇ ਪਾਠ ਕਰਦੇ ਹਾਂ ਤਾਂ ਸਾਰੇ ਪਿੰਡ ਨੂੰ ਮਾਣ ਮਹਿਸੂਸ ਹੁੰਦਾ ਵੀ ਸਾਡੇ ਪਿੰਡ ਦਾ ਨੌਜਵਾਨ ਕੋਈ ਸਿੱਧੇ ਰਸਤੇ ਲੱਗਿਆ ਹੋਇਆ ਉਸ ਕਰਕੇ ਸਾਡੀ ਵੀ ਬੱਲੇ ਬੱਲੇ ਹੁੰਦੀ ਹੈ ਮਾਣ ਮਹਿਸੂਸ ਹੁੰਦਾ ਔਰ ਕਿਤੇ ਵੀ ਫੁੱਟਬਾਲ ਟੂਰਨਾਮੈਂਟ ਹੁੰਦੇ ਆ ਉੱਥੇ ਸਾਰੇ ਸਾਨੂੰ ਮੈਨੂੰ ਕਮੈਂਟਰੀ ਦੇ ਲਈ ਬੁਲਾਉਂਦੇ ਨੇ ਕਿਉਂਕਿ ਬੋਲਣਾ ਵੀ ਕੋਈ ਸੌਖਾ ਕੰਮ ਨਹੀਂ ਹੈਗਾ ਇਸ ਕਰਕੇ ਬੜੀ ਮ ਮਾਣ ਵਾਲ਼ੀ ਗੱਲ ਮਹਿਸੂਸ ਹੁੰਦੀ ਆਪਣੇ ਆਪ 'ਤੇ ਵੀ ਸਾਨੂੰ ਟੂਰਨਾਮੈਂਟਾਂ ਦੇ ਇਨਾਮ ਵੀ ਮਿਲਦੇ ਹੈ ਔਰ ਕਮੈਂਟਰੀ ਕਰਕੇ ਲੋਕਾਂ ਵਿੱਚ ਜਾਣ ਪਛਾਣ ਵੀ ਵੱਧਦੀ ਹੈ